ਅਠਾਰਾਂ ਫਰਵਰੀ ਉੱਨੀ ਸੌ ਅਠਾਨਵੇਂ ਉੱਨੀ ਦਸੰਬਰ ਉੱਨੀ ਸੌ ਨੜਿਨਵੇਂ ਦਸ ਮਈ ਉੱਨੀ ਸੌ ਚੁਰਾਨਵੇਂ ਤੇਰਾਂ ਜੁਲਾਈ ਦੋ ਹਜ਼ਾਰ ਇੱਕ ਗਿਆਰਾਂ ਮਈ ਦੋ ਹਜ਼ਾਰ ਸੱਤ